ਹਾਂਜੀ ਸਤਿ ਸ਼੍ਰੀ ਅਕਾਲ ਜੀ ਰੇਲਵੇ ਸਟੇਸ਼ਨ ਬਰਨਾਲਾ ਤੋਂ ਬੋਲ ਰਹੇ ਜੀ ਅੱਛਾ ਜੀ ਇੱਕ ਨਾ ਥੋੜ੍ਹੀ ਜਾਣਕਾਰੀ ਚਾਹੀਦੀ ਸੀਗੀ ਅਸੀਂ ਪਰਿਵਾਰ ਸਮੇਤ ਜਾਣਾ ਹਜ਼ੂਰ ਸਾਹਿਬ ਅਤੇ ਟਰੇਨ ਦਾ ਟਾਈਮਿੰਗ ਦਾ ਪਤਾ ਕਰਨਾ ਸੀਗਾ ਜੀ ਹਾਂਜੀ ਦੋ ਦਿਨ ਓਕੇ ਅੱਛਾ ਜੀ ਮੈਂ ਪੁੱਛਦਾ ਸੀ ਇੱਥੇ ਕਿੰਨੇ ਕੁ ਚਿਰ ਦਾ ਸਟੋਪੇਜ ਵੀ ਮਤਲਬ ਜਿਵੇਂ ਸਮਾਨ ਸਮੂਨ ਹੋਊਗਾ ਚੜ੍ਹਾਉਣ ਲਾਹੁਣ ਦਾ ਤਿੰਨ ਮਿੰਟ ਦਾ ਓਕੇ ਠੀਕ ਠੀਕ ਠੀਕ ਹਾਂਜੀ ਹਾਂਜੀ ਹਾਂਜੀ ਅਤੇ ਇਹ ਕਿਹੜੇ ਕਿਹੜੇ ਹੋਰ ਕਿਹੜੇ ਕਿਹੜੇ ਜਗ੍ਹਾ ਨੂੰ ਕਨੈਕਟਿਵਿਟੀ ਇੱਥੋਂ ਟ੍ਰੇਨ ਦੀ ਨਹੀਂ ਅਸੀਂ ਤਾਂ ਕੇਰਾਂ ਤਾਂ ਹਜ਼ੂਰ ਸਾਹਿਬ ਦਾ ਹੀ ਕਰਦੇ ਹਾਂ ਫੇਰ ਵੀ ਜੇ ਹੁਣ ਅਸੀਂ ਮੰਨ ਲਉ ਇੱਧਰ ਹਿਮਾਚਲ ਵੱਲ ਜਾਣਾ ਹੋਵੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਅੱਛਾ ਜੀ ਅੱਛਾ ਹਾਂ ਬਸ ਫੇਰ ਅਸੀਂ ਆਨਲਾਈਨ ਟਿਕਟ ਬੁੱਕ ਕਰ ਸਕਦੇ ਹਾਂ ਓਕੇ ਠੀਕ ਹੈ ਜੀ ਠੀਕ ਹੈ ਨਹੀਂ ਫਿਰ ਉਹ ਅਸੀਂ ਇੱਕ ਐਂ ਦੇਖਦੇ ਸੀ ਨਾ ਵੀ ਸਾਨੂੰ ਵੀ ਸਾਰਿਆਂ ਨੂੰ ਇਕੱਠੀ ਜਗ੍ਹਾ ਕ ਕਿਤੇ ਟੁੱਟਵੀਆਂ ਸੀਟਾਂ ਨਾ ਨਾ ਹੋਣ ਠੀਕ ਠੀਕ ਠੀਕ ਠੀਕ ਹੈ ਜੀ ਠੀਕ ਠੀਕ ਹੈ ਓਕੇ ਧੰਨਵਾਦ ਜੀ